ਹੈਲੋ ਹਾਂਜੀ ਸਰ ਅਜੇਰੀਆ ਤੋਂ ਬੋਲ ਰਹੇ ਹੋ ਅੱਛਾ ਜੀ ਅੱਛਾ ਸਰ ਮੈਂ ਉਹ ਜਿਹੜਾ ਕਨਫਰਮ ਕਰਨਾ ਸੀ ਕਿ ਅੱਜ ਤੁਹਾਡਾ ਰੈਸਟੋਰੈਂਟ ਖੁੱਲ੍ਹਾ ਜਾਂ ਨਹੀਂ ਕਿਉਂਕਿ ਇੱਥੇ ਅੱਜ ਅੰਮ੍ਰਿਤਸਰ 'ਚ ਤਾਂ ਸਟ੍ਰਾਈਕ ਚੱਲ ਰਹੀ ਹੈ ਅਤੇ ਘਰ ਗੈਸਟ ਵਗੈਰਾ ਆਏ ਆ ਅਤੇ ਪੁੱਛਣਾ ਸੀ ਕਿ ਤੁਹਾਡਾ ਰੈਸਟੋਰੈਂਟ ਖੁੱਲ੍ਹਾ ਜਾਂ ਨਹੀਂ ਅੱਛਾ ਜੀ ਅੱਛਾ ਜੀ ਖੁੱਲ੍ਹਾ ਤਾਂ ਸਰ ਇੱਕ ਤੁਹਾਡੇ ਤੋਂ ਰਿਕੁਐਸਟ ਹੈ ਕਿ ਜੇ ਤੁਸੀਂ ਔਨਲਾਈਨ ਡਿਲੀਵਰੀ ਵੀ ਜੇ ਨਹੀਂ ਵੀ ਆ ਤਾਂ ਫੇਰ ਵੀ ਤੁਸੀਂ ਭੇਜ ਦਿਉ ਕਿਉਂਕਿ ਉਹ ਗੈਸਟ ਵਗੈਰਾ ਆਏ ਆ ਅਤੇ ਬਾਜ਼ਾਰੋਂ ਕੁਛ ਮਿਲ ਨਹੀਂ ਰਿਹਾ ਸਾਡੇ ਆਸ ਪਾਸ ਤਾਂ ਸਾਰੀਆਂ ਦੁਕਾਨਾਂ ਬੰਦ ਹਨ ਅਤੇ ਤੁਸੀਂ ਦੋ ਪੀਜ਼ਾ ਅਤੇ ਦੋ ਪਾਸਤੇ ਭੇਜ ਦਿਉ ਦੋ ਰੈੱਡ ਸੋਸ ਨਹੀਂ ਨਹੀਂ ਰੈੱਡ ਸੋਸ ਨਹੀਂ ਇੱਕ ਰੈੱਡ ਸੋਸ ਇੱਕ ਵਾਈਟ ਸੋਸ ਪਾਸਤਾ ਅਤੇ ਦੋ ਪੀਜਾ ਪਨੀਰ ਟਿੱਕਾ ਭੇਜ ਸਕਦੇ ਹੋ ਸਰ ਅੱਛਾ ਅੱਛਾ ਪੁੱਛ ਚਲੋ ਪੁੱਛ ਕੇ ਦੱਸ ਦਿਉ ਹੈਲੋ ਸਰ ਹੈਲੋ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਮੈਮ ਭੇਜ ਤਾਂ ਦੇਵਾਂਗਾ ਲੇਕਿਨ ਥੋੜ੍ਹੇ ਡਿਲੀਵਰੀ ਚਾਰਜਿਸ ਜ਼ਿਆਦਾ ਲੱਗਣਗੇ ਕੋਈ ਨਾ ਸਰ ਕਿੰਨੇ ਲੱਗਣਗੇ ਮੈਂ ਪੇ ਕਰ ਦੇਵਾਂਗੀ ਮੈਨੂੰ ਦੱਸ ਦਿਉ ਕਿੰਨਾ ਮੈਂ ਤੁਹਾਨੂੰ ਪੇ ਕਰਾਂ ਅਤੇ ਮੇਰੇ ਘਰ ਦਾ ਐਡਰੈਸ ਵੀ ਤੁਸੀਂ ਲਿਖ ਲਉ ਹਾਂਜੀ ਹਾਂਜੀ ਸਰ ਥੈਂਕ ਯੂ ਸਰ ਅਡਰੈਸ ਲਿਖ ਲਉ ਸਰ ਸ਼ਾਨ ਗਲੀ ਬਾਜ਼ਾਰ ਲਛਮਣ ਸਰ ਹਾਂਜੀ ਹਾਊਸ ਨੰਬਰ ਨੌ ਸੌ ਪੰਜਾਹ ਵਟਾ ਅੱਠ ਹਾਂਜੀ ਹਾਂਜੀ ਸਰ ਸਰ ਆਹ ਫੋਨ ਨੰਬਰ ਵੀ ਲਿਖ ਲਉ ਹਾਂਜੀ ਹਾਂਜੀ ਏਟ ਫਾਈਵ ਸਿਕਸ ਨਾਈਨ ਟ੍ਰਿਪਲ ਜ਼ੀਰੋ ਵੰਨ ਵੰਨ ਜ਼ੀਰੋ ਹਾਂਜੀ ਹਾਂਜੀ ਓਕੇ ਸਰ ਥੈਂਕ ਯੂ ਸਰ ਹਾਂਜੀ ਹਾਂਜੀ ਸਰ ਥੈਂਕ ਯੂ ਸਰ ਥੈਂਕ ਯੂ ਇੱਕ ਵਾਰੀ ਔਡਰ ਕਨਫਰਮ ਕਰ ਲਉ ਸਰ ਦੋ ਪਨੀਰ ਟਿੱਕਾ ਪ ਪੀਜ਼ਾ ਔਰ ਇੱਕ ਰੈੱਡ ਸੋਸ ਪਾਸਤਾ ਔਰ ਇੱਕ ਵਾਈਟ ਸੋਸ ਪਾਸਤਾ ਸਰ ਓਕੇ ਸਰ ਥੈਂਕ ਯੂ ਸਰ ਹਾਂਜੀ ਹਾਂਜੀ ਥੈਂਕ ਯੂ ਸਰ ਥੈਂਕ ਯੂ